ਮੇਰੇ ਸੂਬੇ ਪੰਜਾਬ ਦੇ ਵਿੱਚ ਕਾਫੀ ਕੁਛ ਵਧੀਆ ਹੈ ਪਰ ਜੇਕਰ ਮੈਂ ਕੁਛ ਕੁ ਐਕਜ਼ਾਂਪਲ ਦੇਖਾਂ ਤਾਂ ਜੇਕਰ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਸੈਲਾਨੀ ਬਾਹਰੋਂ ਆਉਂਦੇ ਨੇ ਤਾਂ ਉਹਨਾਂ ਨੂੰ ਮੈਂ ਹੱਥ ਨਾਲ ਬਣਾਈਆਂ ਹੋਈਆਂ ਸਿਨਰੀਜ਼ ਲਜਾਉਂਦੇ ਹੋਏ ਬਹੁਤ ਬਾਰ ਦੇਖਿਆ ਈਵਨ ਕਿ ਮੈਂ ਵੀ ਅੰਮ੍ਰਿਤਸਰ ਤੋਂ ਲੈ ਕੇ ਆਈ ਹਾਂ ਦਰਬਾਰ ਸਾਹਿਬ ਦੀ ਘਰ ਲਗਾਈ ਹੈ ਤਾਂ ਉਹਨੂੰ ਲਗਾਉਂਦੇ ਆ ਜੇਕਰ ਅਸੀਂ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਤੋਂ ਵੀ ਬਹੁਤ ਸਾਰੇ ਜਿਹੜੇ ਬਾਹਰੋਂ ਆਉਂਦੇ ਨੇ ਤਾਂ ਉਹਨਾਂ ਨੂੰ ਮੈਂ ਪੰਜਾਬੀ ਜਿਹੜੀ ਸਾਡੀ ਫੁਲਕਾਰੀ ਹੈ ਪਟਿਆਲਾ ਸ਼ਾਹੀ ਫੁਲਕਾਰੀ ਹੈ ਉਹ ਲਜਾਉਂਦੇ ਦੇਖਿਆ ਪਟਿਆਲੇ ਦੇ ਵਿੱਚ ਹੋਰ ਵੀ ਸੂਟਾਂ ਦੀ ਸ਼ੌਂਪਿੰਗ ਪਟਿਆਲਾ ਜੁੱਤੀ ਇਹ ਸਾਰੇ ਲਜਾਉਂਦੇ ਹੋਏ ਦੇਖਿਆ ਹੈ